ਹੈਲੋ ਤੁਸੀਂ ਫਲਿੱਪਕਾਰਟ ਤੋਂ ਬੋਲ ਰਹੇ ਹੋ ਮੈਂ ਕੁਛ ਦਿਨ ਪਹਿਲਾਂ ਇੱਕ ਰਿੰਗ ਔਡਰ ਕੀਤੀ ਸੀਗੀ ਜਿਸ ਦਾ ਮੌਡਲ ਨੰਬਰ ਬਾਰ੍ਹਾਂ ਸੀਗਾ ਅਤੇ ਉਸ ਦਾ ਸਾਈਜ਼ ਸੀਗਾ ਟੂ ਪੁਆਇੰਟ ਥਰੀ ਅਤੇ ਉਸ ਦਾ ਕਲਰ ਗੋਲਡਨ ਸੀਗਾ ਉਹ ਮੈਨੂੰ ਰਿੰਗ ਬਹੁਤ ਅੱਛੀ ਲੱਗੀ ਸੀਗੀ ਬਟ ਹੁਣ ਕੁਛ ਟਾਈਮ ਦੋ ਦਿਨ ਬਾਅਦ ਹੀ ਉਸਦਾ ਜੋ ਹੈ ਕਲਰ ਨਿਕਲਣਾ ਸ਼ੁਰੂ ਹੋ ਗਿਆ ਹੈ ਕਲਰ ਖ਼ਰਾਬ ਹੋ ਰਿਹਾ ਹੈ ਅਤੇ ਜਿਹੜੇ ਉਸਦੇ ਨਗ ਲੱਗੇ ਹੋਏ ਸੀਗੇ ਉਹ ਵੀ ਸਾਰੇ ਹੀ ਨਿਕਲੇ ਜਾ ਰਹੇ ਨੇ ਜੋ ਕਿ ਬਹੁਤ ਹੀ ਬੁਰਾ ਮੇਰੇ ਲਈ ਐਕਸਪੀਰੀਅੰਸ ਸੀਗਾ ਉਸ ਦਾ ਜੋ ਪ੍ਰੋਡਕਟ ਮੈਂ ਫਲਿੱਪਕਾਰਟ ਦੇ ਉੱਪਰ ਦੇਖਿਆ ਸੀਗਾ ਬਟ ਉਹ ਪ੍ਰੋਡਕਟ ਨਹੀਂ ਸੀਗਾ ਮਿਲਿਆ ਉਸ ਦੇ ਇਲਾਵਾ ਬਟ ਫਿਰ ਵੀ ਮੈਨੂੰ ਉਹ ਰਿੰਗ ਜੋ ਕਿ ਪਸੰਦ ਆਈ ਸੀਗੀ ਤਾਂ ਮੈਂ ਰੱਖ ਲਈ ਬਟ ਜੋ ਕਿ ਉਹ ਹੁਣ ਬਹੁਤ ਹੀ ਖ਼ਰਾਬ ਹੋ ਜ ਹੋਈ ਜਾ ਰਹੀ ਆ ਮੈਂ ਇੱਕ ਤਾਂ ਉਸ ਮੈਂ ਡਿਲੀਵਰੀ ਦੀ ਦੋ ਵਾਰ ਕੰਪਲੇਂਨ ਕਰ ਚੁੱਕੀ ਹਾਂ ਕਿ ਇਹ ਗਲ਼ਤ ਪ੍ਰੋਡਕਟ ਮੇਰੇ ਕੋਲ ਭੇਜਿਆ ਗਿਆ ਹੈ ਮੈਂ ਇਹ ਡਿਲੀਵਰੀ ਕੈਸ਼ ਔਨ ਡਿਲੀਵਰੀ ਕੀਤੀ ਸੀਗੀ ਅਤੇ ਜਿਹੜੀ ਡਿਲੀਵਰੀ ਆ ਓਹ ਵੀ ਬਹੁਤ ਲੇਟ ਹੋਈ ਸੀਗੀ ਮੈਂ ਮੈਰਿਜ 'ਤੇ ਜਾਣਾ ਸੀਗਾ ਜੋ ਅਤੇ ਉੱਥੇ ਫਿਰ ਜੋ ਮੇਰੇ ਕੋਲ ਪ੍ਰੋਡਕਟ ਆਇਆ ਮੈਂ ਉਹੀ ਪਾ ਕੇ ਚਲੀ ਗਈ ਬਟ ਹੁਣ ਇਹ ਜੋ ਹੈ ਪ੍ਰੋਡਕਟ ਉਹ ਖਰਾਬ ਹੋਇਆ ਜਾ ਰਿਹਾ ਹੈ ਮੈਂ ਔਲਰੈਡੀ ਕਪਲੇਂਨ ਕਰ ਚੁੱਕੀ ਹਾਂ ਬਟ ਕੋਈ ਧਿਆਨ ਨਹੀਂ ਦਿੱਤਾ ਗਿਆ ਸੋ ਮੈਂ ਰਿਕੂਐਸਟ ਕਰਦੀ ਹਾਂ ਕਿ ਇਹ ਜੋ ਹੈ ਪ੍ਰੋਡਕਟ ਮੈਨੂੰ ਦੁਬਾ ਦੁਬਾਰਾ ਜੋ ਹੈ ਸਹੀ ਪ੍ਰੋਡਕਟ ਭੇਜਿਆ ਜਾਵੇ ਥੈਂਕ ਯੂ